ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਮੈਂ ਅਮਨਜੀਤ ਕੌਰ ਬੋਲ ਰਹੀ ਹਾਂ ਅਤੇ ਮੈਂ ਤੁਹਾਡੀ ਸਟੂਡੈਂਟ ਹਾਂ ਅਤੇ ਤੁਹਾਨੂੰ ਇੱਕ ਨਾ ਮੈਂ ਫਰੀਡਮ ਫਾਈਟਰ ਸਰਦਾਰ ਭਗਤ ਸਿੰਘ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੀ ਹਾਂ ਕੀ ਤੁਸੀਂ ਮੈਨੂੰ ਦੱਸੋਗੇ ਜੀ ਭਗਤ ਸਿੰਘ ਬਾਰੇ ਆਪਾਂ ਪੂਰੇ ਵਿਸਥਾਰ ਨਾਲ ਕਿਵੇਂ ਸ਼ੁਰੂਆਤ ਕਰਕੇ ਉਹਨਾਂ ਦੀ ਜੋ ਦੇਸ਼ ਦੀ ਆਜ਼ਾਦੀ ਲਈ ਜੋ ਯੋਗਦਾਨ ਰਿਹਾ ਆਪਾਂ ਕਿਵੇਂ ਉਹਨੂੰ ਪੇਸ਼ ਕਰ ਸਕਦੇ ਹਾਂ ਆਪਣੀ ਪੰਜਾਬੀ ਭਾਸ਼ਾ 'ਚ ਹਾਂਜੀ ਠੀਕ ਹੈ ਜੀ ਅੱਛਾ ਜੀ ਹਾਂਜੀ ਅੱਛਾ ਜੀ ਹਾਂਜੀ ਤੁਹਾਡਾ ਮਤਲਬ ਕਿ ਉਹਨਾਂ ਨੂੰ ਬਚਪਨ ਤੋਂ ਹੀ ਆਜ਼ਾਦੀ ਦੇ ਸੰਘਰਸ਼ ਨਾਲ ਪਿਆਰ ਸੀ ਹਾਂਜੀ ਹੁੰ ਹੁੰ ਹੁੰ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਜੀ ਠੀਕ ਹੈ ਜੀ ਮੈਂ ਧੰਨਵਾਦ ਬਹੁਤ ਧੰਨਵਾਦ ਤੁਹਾਡਾ